ਕਿਚਨ 'ਚ ਖਾਣਾ ਬਣਾਉਣ ਟਾਈਮ ਆਪਾਂ ਨੂੰ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਸ ਤਰ੍ਹਾਂ ਕਿ ਪਰਾਤ ਜਿਸ ਵਿੱਚ ਆਪਾਂ ਆਟਾ ਗੁੰਨਦੇ ਹਾਂ ਉਸ ਤੋਂ ਇਲਾਵਾ ਕੁੱਕਰ ਜਿਸ ਵਿੱਚ ਸਬਜ਼ੀ ਬਣਦੀ ਹੈ ਔਰ ਗੈਸ ਜਿਹਦੇ ਉੱਪਰ ਸਭ ਕੁਝ ਪਕਾਇਆ ਜਾਂਦਾ ਹੈ ਔਰ ਫੁਲਕਾ ਬਣਾਉਣ ਵਾਸਤੇ ਤਵੇ ਦੀ ਜਰੂਰਤ ਪੈਂਦੀ ਹੈ ਔਰ ਫੁਲਕੇ ਨੂੰ ਵੇਲਣੇ ਵਾਸਤੇ ਚੱਕਲਾ ਵੇਲਣਾ ਔਰ ਜੋ ਪਲੇਥਨ ਰੱਖਦੇ ਹਾਂ ਉਹਦੇ ਵਾਸਤੇ ਅਲੱਗ ਇਕ ਬੋਕਸ ਹੁੰਦਾ ਜਿਹਦੇ ਵਿੱਚ ਸੁੱਕਾ ਆਟਾ ਹੁੰਦਾ ਉਸ ਤੋਂ ਇਲਾਵਾ ਆਪਾਂ ਜਿਸ ਤਰ੍ਹਾਂ ਕੁਛ ਬੇਕ ਕਰਨਾ ਤਾਂ ਉਹਦੇ ਵਾਸਤੇ ਆਪਾਂ ਨੂੰ ਮਾਈਕ੍ਰੋਵੇਵ ਜਾਂ ਓਵਨ ਦੀ ਜ਼ਰੂਰਤ ਪੈਂਦੀ ਹੈ ਇਸ ਤੋਂ ਇਲਾਵਾ ਮਿਕਸੀ ਜਿਸ ਤਰ੍ਹਾਂ ਮਿਕਸਿੰਗ ਮਸਾਲਾ ਪੀਸਣਾ ਆਪਾਂ ਉਸਦੀ ਬਹੁਤ ਜਰੂਰਤ ਕਰਦੀ ਹੈ ਪਾਣੀ ਵਾਸਤੇ ਆਪਾਂ ਨੂੰ ਕੈਂਪਰ ਜਾਂ ਘੜਾ ਜ਼ਿਆਦਾਤਰ ਆਪਾਂ ਯੂਜ਼ ਕਰਦੇ ਹਾਂ ਫਿਲਟਰ ਵੀ ਅੱਜ ਕੱਲ੍ਹ ਆ ਗਏ ਫਿਲਟਰ ਦੀ ਯੂਜ਼ ਵੀ ਬਹੁਤ ਹੁੰਦੀ ਹੈ ਉਸ ਤੋਂ ਇਲਾਵਾ ਬਰਤਨ ਜਿਸ ਤਰ੍ਹਾਂ ਕਿ ਕੌਲੀਆਂ ਗਿਲਾਸਾਂ ਫਰਾਈਪੈਨ ਜਿਸ ਵਿੱਚ ਚਾਹ ਬਣਾਈ ਜਾਂਦੀ ਹੈ ਔਰ ਕੜਾਹੀ ਜਿਸ ਵਿੱਚ ਆਪਾਂ ਪੂਰੀਆਂ ਤਲਦੇ ਹਾਂ ਕਚੋਰੀਆਂ ਬਣਾਉਂਦੇ ਹਾਂ ਉਸ ਤੋਂ ਇਲਾਵਾ ਪਤੀਲੀ ਜਿਸ ਵਿੱਚ ਸੁੱਕੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਸੁੱਕੀ ਸਬਜ਼ੀ ਵਾਸਤੇ ਜ਼ਿਆਦਾਤਰ ਪਤੀਲੇ ਜਾਂ ਪਤੀਲੀਆਂ ਦੀ ਲੋੜ ਪੈਂਦੀ ਹੈ ਔਰ